ਸਾਰੇ ਗ੍ਰਹਿਆਂ ਵਿੱਚੋ ਸਭ ਤੋਂ ਆਕਰਸ਼ਿਤ ਗ੍ਰਹਿ ਜਿਹੜਾ ਮੈਨੂੰ ਉਹ ਸੂਰਜ ਲੱਗਦਾ ਹੈ ਸੂਰਜ ਜਿਹੜਾ ਹੈ ਉਹ ਸਾਨੂੰ ਪ੍ਰਕਾਸ਼ਿਤ ਕਰਦਾ ਹੈ ਉਹ ਸਾਨੂੰ ਸੰਬੋਧਿਤ ਕਰਦਾ ਹੈ ਕਿ ਕਿਵੇਂ ਸਾਰੇ ਸੰਸਾਰ ਦੇ ਵਿੱਚ ਉਹ ਆਪਣੇ ਪ੍ਰਕਾਸ਼ ਨਾਲ ਚਾਨਣ ਕਰਦਾ ਹੈ ਅਤੇ ਕਿਵੇਂ ਉਸ ਚਾਨਣ ਨਾਲ ਸਾਡਾ ਜਿਹੜਾ ਹੈ ਦਿਨ ਸ਼ੁਰੂ ਹੁੰਦਾ ਹੈ ਇਸ ਕਰਕੇ ਜਿਹੜਾ ਸਭ ਤੋਂ ਵਧੀਆ ਗ੍ਰਹਿ ਹੈ ਉਹ ਮੈਨੂੰ ਸੂਰਜ ਲੱਗਦਾ ਹੈ